ਸਤਿ ਸ਼੍ਰੀ ਅਕਾਲ ਸਾਰੇ ਮੇਰੇ ਭੈਣਾਂ ਅਤੇ ਭਰਾਵਾਂ ਨੂੰ ਮੈਂ ਮਾਨਵ ਸਿੰਘ ਪਠਾਨਕੋਟ ਵਿੱਚ ਰਹਿੰਦਾ ਹਾਂ ਜਿੱਦਾਂ ਕਿ ਇਹਨਾਂ ਦਾ ਪ੍ਰਸ਼ਨ ਹੈ ਕਿ ਕਿ ਤੁਸੀਂ ਕਦੇ ਕਿਸੇ ਔਨਲਾਈਨ ਗੇਮਿੰਗ ਟੂਰਨਾਮੈਂਟ ਜਾਂ ਮੁਕਾਬਲੇ ਵਿੱਚ ਹਿੱਸਾ ਲਿਆ ਹੈ ਅਗਰ ਮੈਂ ਇਸ ਪ੍ਰਸ਼ਨ ਦਾ ਜਵਾਬ ਦੇਣਾ ਚਾਹਵਾਂਗਾ ਤਾਂ ਮੇਰਾ ਸਵਾਹ ਮੇਰਾ ਜਵਾਬ ਇਹ ਹੋਏਗਾ ਕਿ ਹਾਂ ਮੈ ਇੱਕ ਅੰਡਰ ਗ੍ਰੈਜੂਏਟ ਸਟੂਡੈਂਟ ਹਾਂ ਮੈਂ ਗੁਰਦਾਸਪੁਰ ਵਿੱਚ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਵਿੱਚ ਸੀ ਐਸ ਸੀ ਕਮ ਜਿਹਨੂੰ ਕਿ ਆਪਾਂ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਕਹਿੰਦੇ ਹਾਂ ਮੈਂ ਉਹ ਕਰ ਰਿਹਾ ਹਾਂ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਵੱਖ ਵੱਖ ਕੋਲਜਾਂ ਵਿੱਚ ਯੂਨੀਵਰਸਿਟੀਆਂ ਵਿੱਚ ਕਾਫੀ ਸਾਰੀ ਅਤੇ ਕਾਫੀ ਪ੍ਰਕਾਰ ਦੀਆਂ ਸੁਸਾਇਟੀਆਂ ਹੁੰਦੀਆਂ ਹਨ ਉੱਦਾਂ ਹੀ ਮੇਰੀ ਯੂਨੀਵਰਸਿਟੀ ਵਿੱਚ ਇੱਕ ਗੇਮਿੰਗ ਸੋਸਾਇਟੀ ਹੈ ਜਿਸ ਦਾ ਨਾਂ ਸੀ ਟੀ ਐਸ ਹੈ ਉਹ ਹਰ ਹਫਤੇ ਵਿੱਚ ਇੱਕ ਨਾ ਇੱਕ ਗੇਮਿੰਗ ਟੂਰਨਾਮੈਂਟ ਕਰਵਾਉਂਦੇ ਹਨ ਉਨ੍ਹਾਂ ਦੇ ਜੋ ਈਵੈਂਟ ਕੋਆਰਡੀਨੇਟਰ ਹਨ ਉਹਨਾਂ ਦਾ ਨਾਂ ਰਮਨ ਹੈ ਅਤੇ ਜੋ ਸੀ ਟੀ ਐਸ ਸੋਸਾਇਟੀ ਹੈ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਦੀ ਉਹਦੇ ਜੋ ਪ੍ਰੈਜੀਡੈਂਟ ਹਨ ਉਹ ਹਨ ਸੌਰਵ ਜੇ ਮੈਂ ਵਾਈਸ ਪ੍ਰੈਜੀਡੈਂਟ ਦੀ ਗੱਲ ਕਰਾਂ ਤਾਂ ਉਹ ਨੇ ਸਾਕਸ਼ੀ ਇਹ ਟੂਰਨਾਮੈਂਟ ਜਿਹਨਾਂ ਦੀ ਰੇਖ ਦੇਖ ਦੇ ਅੰਦਰ ਹੁੰਦਾ ਹੈ ਜੋ ਕਿ ਟੀਚਰ ਇੰਨਚਾਰਜ ਹਨ ਉਹਨਾ ਦਾ ਨਾਂ ਹੈ ਮਿਸਟਰ ਗੁਰਪ੍ਰੀਤ ਸਿੰਘ ਅਗਰ ਮੈਂ ਗੱਲ ਕਰਾਂ ਤਾਂ ਇਹਨਾਂ ਨੇ ਬੀ ਜੀ ਐਮ ਆਈ ਈ ਸਪੋਰਟਸ ਦਾ ਟੂਰਨਾਮੈਂਟ ਕਰਵਾਇਆ ਸੀ ਜੋ ਕਿ ਪਬਜੀ ਗੇਮ ਸੀ ਜਿੱਦਾਂ ਕਿ ਆਪ ਸਾਰਿਆਂ ਨੂੰ ਪਤਾ ਹੈ ਕਿ ਪਬਜੀ ਗੇਮ ਅੱਜ ਕੱਲ ਕਿੰਨੀ ਚੜ੍ਹੀ ਹੋਈ ਹੈ ਉਸ ਗੇਮ ਵਿੱਚ ਮੈਂ ਪਾਟੀਸਪੇਟ ਕੀਤਾ ਸੀ ਮੇਰੀ ਪਾਟੀਸਪੇਟ ਕਰਨ ਦੀ ਡੇਟ ਸਤਾਈ ਫਰਵਰੀ ਦੋ ਹਜ਼ਾਰ ਚੌਵੀ ਸੀ ਇਸ ਈਵੈਂਟ ਦੀ ਟੂਰਨਾਮੈਂਟ ਜਦ ਹੋਣਾ ਸੀ ਇਹਦਾ ਟਾਈਮ ਸੀ ਰਾਤ ਦਾ ਨੌ ਤੋਂ ਦਸ ਵਜੇ ਅਤੇ ਇਹਨਾਂ ਨੇ ਇਸ ਟੂਰਨਾਮੈਂਟ ਦਾ ਬਹੁਤ ਹੀ ਵਧੀਆ ਕੈਸ਼ ਪ੍ਰਾਈਜ਼ ਰੱਖਿਆ ਹੋਇਆ ਸੀ ਜਿੱਦਾਂ ਕਿ ਆਪ ਜੀ ਨੂੰ ਪਤਾ ਹੈ ਕੋਈ ਵੀ ਟੂਰਨਾਮੈਂਟ ਖੇਡੋ ਤਾਂ ਉਹਦੀ ਵੱਖ ਵੱਖ ਪੁਜ਼ੀਸ਼ਨਾਂ ਆਉਂਦੀਆਂ ਹੈ ਜਿੱਦਾਂ ਕਿ ਪਹਿਲੀ ਦੂਜੀ ਤੀਜੀ ਉੱਦਾਂ ਹੀ ਇਹਨਾਂ ਨੇ ਕੈਸ਼ ਪ੍ਰਾਈਜ ਰੱਖੇ ਹੋਏ ਸੀ ਜਿੱਦਾਂ ਕਿ ਪਹਿਲੀ ਪੁਜੀਸ਼ਨ ਵਾਲਿਆਂ ਨੂੰ ਇਹਨਾਂ ਨੇ ਦੋ ਹਜ਼ਾਰ ਦੇਣ ਦਾ ਵਾਅਦਾ ਕੀਤਾ ਅਗਰ ਆਪਾਂ ਦੂਜੀ ਪੁਜੀਸ਼ਨ 'ਤੇ ਆਏ ਤਾਂ ਸਾਨੂੰ ਹਜ਼ਾਰ ਜੇ ਆਪਾਂ ਤੀਜੀ ਪੁਜੀਸ਼ਨ 'ਤੇ ਆਏ ਤਾਂ ਸਾਨੂੰ ਚਾਰ ਸੌ ਰੁਪਏ ਮਿਲਣਗੇ ਇਸ ਤਰ੍ਹਾਂ ਮੈਂ ਇਸ ਗੇਮ ਨੂੰ ਪਾਰਟੀਸਪੇਟ ਕੀਤਾ ਅਤੇ ਦੂਜੀ ਪੁਜੀਸ਼ਨ ਹਾਸਲ ਕੀਤੀ ਅਤੇ ਜਿਸ ਤਰ੍ਹਾਂ ਇਹਨਾਂ ਨੇ ਆਪਣਾ ਵਾਅਦਾ ਕੀਤਾ ਹੋਇਆ ਸੀ ਉੱਦਾਂ ਹੀ ਇਹਨਾਂ ਨੇ ਮੈਨੂੰ ਹਜ਼ਾਰ ਰੁਪਇਆ ਦੇ ਦਿੱਤਾ ਜੋ ਕਿ ਮੈਨੂੰ ਬਹੁਤ ਵਧੀਆ ਲੱਗਿਆ ਧੰਨਵਾਦ